ਹਾਂਜੀ ਮੇਰੇ ਕੋਲ ਇੱਕ ਮੇਰੀ ਮਨਪਸੰਦ ਕਿਤਾਬ ਹੈ ਜੋ ਕਿ ਭਗਤ ਸਿੰਘ ਅਤੇ ਉਹਦੇ ਸਾਥੀਆਂ ਦੀ ਜੀਵਨੀ ਬਾਰੇ ਦੱਸਦੀ ਹੈ ਜੇਕਰ ਆਪਾਂ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਇਹ ਕਿਤਾਬ ਨੂੰ ਪੜ੍ਹਿਆ ਜਾਵੇ ਤਾਂ ਆਪਾਂ ਨੂੰ ਭਗਤ ਸਿੰਘ ਦੇ ਸਾਥੀਆਂ ਦੀ ਕੁਰਬਾਨੀ ਦਾ ਵੀ ਪਤਾ ਲੱਗਦਾ ਹੈ ਅਤੇ ਭਗਤ ਸਿੰਘ ਦੇ ਸਮੇਂ ਸਮੇਂ 'ਤੇ ਕੀਤੇ ਸੰਘਰਸ਼ਾਂ ਦੀ ਜਾਣਕਾਰੀ ਵੀ ਇਹ ਕਿਤਾਬ ਬਹੁਤ ਹੀ ਸਰਲ ਅਤੇ ਸੌਖੇ ਤਰੀਕੇ ਨਾਲ ਦਿੰਦੀ ਹੈ ਮੈਂ ਇਸ ਕਿਤਾਬ ਨੂੰ ਸਮੇਂ ਸਮੇਂ 'ਤੇ ਪੜ੍ਹਦਾ ਰਹਿੰਦਾ ਹਾਂ ਸੋ ਇਹ ਮੇਰੀ ਬਹੁਤ ਹੀ ਜ਼ਿਆਦਾ ਮਨਪਸੰਦ ਕਿਤਾਬ ਹੈ